ਹਾਂ ਕੁਝ ਅਜਿਹੇ ਵਿਸ਼ੇ ਹਨ ਜਿਨ੍ਹਾਂ ਬਾਰੇ ਮੈਂ ਲਿਖਣਾ ਚਾਹੁੰਦੀ ਹਾਂ ਅਤੇ ਮੈਂ ਸ਼ੱਕੀ ਹਾਂ ਅਜਿਹੇ ਸਮੇਂ ਦੇ ਵਿਸ਼ੇ ਹਨ ਜਿਹੜੇ ਮੇਰੇ ਜਿਹੜੇ ਭਾਰਤ ਵਿੱਚ ਵਰਜਿਤ ਹਨ ਜਿਵੇਂ ਸੈਕਸ ਰੀਲੇਟਿਡ ਇਸ ਦੀ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਜੋ ਕਿ ਬਾਹਰਲੇ ਦੇਸ਼ਾਂ ਵਿੱਚ ਕਾਫੀ ਦਿੱਤੀ ਜਾਂਦੀ ਹੈ ਅਤੇ ਮੇਰੇ ਹਿਸਾਬ ਨਾਲ ਸਾਡੇ ਦੇਸ਼ ਵਿੱਚ ਵੀ ਦੇਣੀ ਚਾਹੀਦੀ ਹੈ ਤਾਂ ਕਿ ਲੋਕ ਇਸ ਬਾਰੇ ਚੰਗੀ ਤਰ੍ਹਾਂ ਜਾਗਰੂਕ ਹੋਣ ਅਤੇ ਕੋਈ ਵੀ ਗਲਤ ਚੀਜ਼ਾਂ ਨਾ ਕਰਨ